ਹਾਲ ਹੀ ਦੇ ਵਿੱਚ ਬਜ਼ਾਰ ਵਿੱਚੋਂ ਮੈਂ ਇੱਕ ਫੋਟੋਗਰਾ ਖਰੀਦਿਆ ਮੇਰੇ ਉਂਝ ਬਹੁਤ ਪਸੰਦੀਦੇ ਫੋਟੋਗਰਾ ਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਮੈਂ ਨਵੇਂ ਵਰਜਨ ਦੇ ਵਿੱਚ ਆਇਆ ਫੋਟੋਗਰਾ ਜਦੋਂ ਖਰੀਦਿਆ ਅਤੇ ਮੈਨੂੰ ਬਹੁਤ ਚੰਗਾ ਲੱਗਿਆ ਹਾਲਾਂਕਿ ਪਹਿਲਾਂ ਵੀ ਮੈਂ ਕਈ ਫੋਟੋਗਰਾ ਨੂੰ ਵਰਤਦਾ ਰਿਹਾ ਚਲਾਉਂਦਾ ਰਿਹਾ ਅਤੇ ਪਰ ਇਹ ਇਹਨਾਂ ਦਿਨਾਂ ਦੇ ਵਿੱਚ ਬਜ਼ਾਰ ਮਾਰਕੀਟ ਦੇ ਵਿੱਚ ਨਵਾਂ ਆਇਆ ਫੋਟੋਗਰਾ ਜਿਹੜਾ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਹਦੇ ਫੰਕਸ਼ਨ ਅਤੇ ਉਹਦੇ ਵਿਚਲੇ ਜਿੰਨੇ ਵੀ ਫੰਕਸ਼ਨ ਸੀ ਉਹ ਬਹੁਤ ਜ਼ਿਆਦਾ ਮੈਨੂੰ ਵਧੀਆ ਲੱਗੇ ਅਤੇ ਇਹਦੇ ਪਿੱਛੇ ਦੀ ਕਹਾਣੀ ਇਹ ਆ ਵੀ ਇਹ ਮੈਂ ਮੇਰੇ ਦੋਸਤ ਦੇ ਕਹਿਣ ਦੇ ਉੱਤੇ ਖਰੀਦਿਆ ਦੁਕਾਨਦਾਰ ਦਾ ਵੀ ਮੇਰੇ ਦੋਸਤ ਨੇ ਹੀ ਮੈਨੂੰ ਦੱਸਿਆ ਸੀ ਅਤੇ ਫੋਟੋਗਰਾ ਬਾਰੇ ਵੀ ਮੇਰੇ ਦੋਸਤ ਨੇ ਮੈਨੂੰ ਦੱਸਿਆ ਸੀ ਅਤੇ ਜਿਹਨਾਂ ਦੁਕਾਨਦਾਰ ਕੋਲੋਂ ਇਹ ਖਰੀਦਿਆ ਉਹਨਾਂ ਦੀ ਡੀਲਿੰਗ ਵੀ ਬਹੁਤ ਵਧੀਆ ਲੱਗੀ ਮੈਨੂੰ ਜਿੰਨੀ ਕਿ ਇਸ ਫੋਟੋਗਰਾ ਬਾਰੇ ਮੈਨੂੰ ਵਧੀਆ ਲੱਗਿਆ ਬਹੁਤ ਧੰਨਵਾਦ